ਹੈਲੋ ਜੀ ਤੁਸੀਂ ਰਵੀ ਕੁਮਾਰ ਜੀ ਗੱਲ ਕਰ ਰਹੇ ਹੋ ਜੀ ਮੈਂ ਕ੍ਰੀਤੀਕਾ ਸਿੰਘ ਗਰੀਨ ਪੈਲੇਸ ਰੂਪਨਗਰ ਤੋਂ ਗੱਲ ਕਰ ਰਹੀ ਹਾਂ ਜੀ ਮੈਨੂੰ ਨਾ ਕੱਲ੍ਹ ਦੇ ਲਈ ਟੈਕਸੀ ਬੁੱਕ ਕਰਾਉਣੀ ਸੀ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਅਤੇ ਮੈਂ ਮੈਨੂੰ ਰੂਪਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਲਈ ਟੈਕਸੀ ਬੁੱਕ ਕਰਾਉਣੀ ਹੈ ਅਤੇ ਵਿਚਲੇ ਵਿੱਚ ਵੀ ਕੁਝ ਸਥਾਨਾਂ ਦੇ ਲਈ ਮੈਨੂੰ ਇਹ ਟੈਕਸੀ ਬੁੱਕ ਕਰਾਉਣੀ ਹੈ ਅਤੇ ਇਸਦੇ ਵਿੱਚ ਟੋਟਲ ਚਾਰ ਪੰਜ ਲੋਕ ਹੋਣਗੇ ਅਤੇ ਹੋ ਸਕੇ ਤਾਂ ਤੁਸੀਂ ਮੈਨੂੰ ਇਹਦੇ ਕੀ ਚਾਰਜਿਸ ਹੈ ਤੁਸੀਂ ਮੈਨੂੰ ਉਹ ਦੱਸ ਦਿਉ ਅਤੇ ਹੋ ਸਕੇ ਤਾਂ ਮੈਂ ਫਿਰ ਤੋਂ ਦੱਸ ਰਹੀ ਹਾਂ ਮੈਨੂੰ ਕੱਲ੍ਹ ਸਵੇਰੇ ਪੱਚੀ ਚਾਰ ਦੋ ਹਜ਼ਾਰ ਤੇਈ ਸਵੇਰੇ ਛੇ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਟੈਕਸੀ ਬੁੱਕ ਕਰਾਉਣੀ ਹੈ ਅਤੇ ਚਾਰ ਪੰਜ ਲੋਕਾਂ ਦੇ ਲਈ ਧੰਨਵਾਦ ਜੀ